ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜੇਕਰ ਗੱਲ ਕਰੀਏ ਸਾਡੇ ਭਾਈਚਾਰੇ ਦਾ ਧਾਰਮਿਕ ਆਗੂ ਕੌਣ ਹੈ ਤਾਂ ਦੇਖੋ ਮੇਰੀ ਤਾਂ ਸਿੱਧੀ ਇਹ ਗੱਲ ਹੈ ਕਿ ਮੈਂ ਰੱਬ ਨੂੰ ਮੰਨਦਾ ਹਾਂ ਸਭ ਤੋਂ ਉੱਚਾ ਦਰਿਆ ਮੈਂ ਰੱਬ ਨੂੰ ਦਿੰਦਾ ਹਾਂ ਅਤੇ ਉਸ ਤੋਂ ਬਾਅਦ ਜੇ ਮੈਂ ਇੰਝ ਕਹਿ ਲਓ ਕਿ ਜੇ ਮੈਂ ਉੱਚਾ ਦਰਜਾ ਦੇਣ ਦੀ ਗੱਲ ਕਰਾਂ ਤਾਂ ਉਹ ਮਾਂ ਬਾਪ ਹੁੰਦੇ ਹਨ ਤਾਂ ਮੈਂ ਮਾਂ ਬਾਪ ਅਤੇ ਰੱਬ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ ਅਤੇ ਉਸ ਦੇ ਨਾਲ ਗੁਰੂ ਨੂੰ ਵੀ ਅਤੇ ਇਹਨਾਂ ਸਭ ਦੀ ਮੇਰੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਹੈ ਕਿਉਂਕਿ ਇਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਤੋਂ ਮਿਲਦਾ ਹੈ ਜਿਵੇਂ ਕਿ ਜੇ ਅਸੀਂ ਮਾਂ ਬਾਪ ਦੀ ਗੱਲ ਕਰੀਏ ਤਾਂ ਉਹ ਸਾਨੂੰ ਸਭ ਤੋਂ ਪਹਿਲਾਂ ਹਰ ਚੀਜ਼ ਸਿਖਾਉਂਦੇ ਨੇ ਉਸ ਤੋਂ ਬਾਅਦ ਜੇ ਗੁਰੂ ਦੀ ਗੱਲ ਕਰੀਏ ਤਾਂ ਉਹ ਸਾਡਾ ਸਾਰਾ ਕੁਛ ਵੇਖਦਾ ਹੈ ਸਾਡੇ ਨਾਲ ਵਿਚਰਦਾ ਹੈ ਸਾਨੂੰ ਹਰ ਗਲਤੀਆਂ 'ਤੇ ਮਤਲਬ ਰੋਕਦਾ ਹੈ ਹਰ ਚੀਜ਼ ਸਿਖਾਉਂਦਾ ਫਿਰ ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਰੱਬ ਦੀ ਤਾਂ ਉਹ ਤਾਂ ਸਦਾ ਹਮੇਸ਼ਾਂ ਸਾਡੇ ਨਾਲ ਹੀ ਰਹਿੰਦਾ ਹੈ ਅਤੇ ਜੇ ਮੈਨੂੰ ਮਾਂ ਪਿਓ ਅਤੇ ਅਤੇ ਗੁਰੂ ਮੇਰੇ ਗੁਰੂ ਕੋਈ ਮੈਨੂੰ ਸਲਾਹ ਦਿੰਦੇ ਹਨ ਤਾਂ ਉਹ ਹਰ ਵਾਰ ਇੱਕੋ ਸਲਾਹ ਦਿੰਦੇ ਹਨ ਕਿ ਸਾਨੂੰ ਜ਼ਿੰਦਗੀ 'ਚ ਹਮੇਸ਼ਾਂ ਚੰਗੇ ਕੰਮ ਕਰਨੇ ਚਾਹੀਦੇ ਹਨ ਜੋ ਕਿ ਸਾਡੇ ਲਈ ਬਹੁਤ ਚੰਗੀ ਗੱਲ ਹੋਵੇਗੀ ਅਤੇ ਇਹ ਮੇਰੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ